ਵਿਆਹ ਵਿੱਚ ਲਾੜੀ ਨੂੰ ਬਹੁਤ ਸਾਰੇ ਤੋਹਫ਼ੇ ਪ੍ਰਾਪਤ ਹੁੰਦੇ ਹਨ ਦਾਜ ਦੀ ਗੱਲ ਕਰੀਏ ਤਾਂ ਇਸ ਵਿੱਚ ਉਸਨੂੰ ਉਸਦੇ ਜੀਵਨ ਵਿੱਚ ਕੰਮ ਆਉਣ ਵਾਲੇ ਤੋਹਫ਼ੇ ਜ਼ਿਆਦਾ ਦਿੱਤੇ ਜਾਂਦੇ ਹਨ ਜੋ ਘਰ ਵਿੱਚ ਆਮ ਵਰਤੇ ਜਾਂਦੇ ਹਨ ਜਿਵੇਂ ਬੈੱਡ ਅਲਮਾਰੀ ਸੋਫ਼ਾ ਸੈੱਟ ਰਸੋਈ ਦੇ ਸਮਾਨ ਵਿੱਚ ਭਾਂਡਿਆਂ ਦੇ ਸੈੱਟ ਅਤੇ ਬਿਸਤਰੇ ਆਦਿ ਦਿੱਤੇ ਜਾਂਦੇ ਹਨ ਇਹ ਸਾਰਾ ਸਮਾਨ ਉਸਦੇ ਨਿੱਜੀ ਵਰਤੋਂ ਵਿੱਚ ਕੰਮ ਆਉਂਦਾ ਹੈ ਅਤੇ ਇਹ ਉਸਦੇ ਲਈ ਬਹੁਤ ਸੁਖਦਾਇਕ ਹੁੰਦਾ ਹੈ ਇਸ ਤੋਂ ਇਲਾਵਾ ਉਸਨੂੰ ਹੋਰ ਵੀ ਬਹੁਤ ਸਾਰੇ ਤੋਹਫ਼ੇ ਉਸ ਦੀਆਂ ਸਹੇਲੀਆਂ ਉਸਦੇ ਗਵਾਂਢੀਆਂ ਅਤੇ ਹੋਰ ਦੋਸਤ ਮਿੱਤਰਾਂ ਕੋਲ਼ੋਂ ਮਿਲਦੇ ਹਨ ਅਤੇ ਜਿਵੇਂ ਮਾਂ ਵੱਲੋਂ ਨਾਨੀ ਵੱਲੋਂ ਕੁਝ ਰਵਾਇਤੀ ਕੱਪੜੇ ਅਤੇ ਪੈਸੇ ਅਤੇ ਹੋਰ ਸਮਾਨ ਵੀ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਨਿਕ ਸੁੱਕ ਦਾ ਸਮਾਨ ਜੋ ਲਾੜੀ ਚਾਹੁੰਦੀ ਹੋਵੇ ਜਾਂ ਉਸ ਦੇ ਘਰ ਦੇ ਉਸਨੂੰ ਦੇਣਾ ਚਾਹੁੰਦੇ ਹੋਣ ਉਹ ਉਸਨੂੰ ਆਪਣੀ ਮਰਜ਼ੀ ਨਾਲ਼ ਦੇ ਦਿੰਦੇ ਹਨ ਪਰ ਜੇ ਆਮ ਦੇਖਿਆ ਜਾਵੇ ਤਾਂ ਦਾਜ ਦੇ ਵਿੱਚ ਦੇਣ ਵਾਲਾ ਸਮਾਨ ਹੀ ਲਾੜੀ ਨੂੰ ਤੋਹਫ਼ੇ ਦੇ ਵਿੱਚ ਦਿੱਤਾ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਬੈੱਡ ਅਲਮਾਰੀ ਆਦਿ ਚੀਜ਼ਾਂ ਹੀ ਉਸਦੇ ਦਾਜ ਵਿੱਚ ਜਾਂਦੀਆਂ ਹਨ